ਮੇਰੀ ਸਭ ਤੋਂ ਵੱਡੀ ਸ਼ਕਤੀ ਮੇਰੇ ਪਰਿਵਾਰ ਦਾ ਸਾਥ ਹੈ ਕਿਉਂਕਿ ਜਦੋਂ ਵੀ ਮੈਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਮੇਰਾ ਪਰਿਵਾਰ ਮੇਰੇ ਨਾਲ਼ ਖੜ੍ਹਾ ਰਹਿੰਦਾ ਹੈ ਅਤੇ ਮੈਨੂੰ ਇਸ ਨਾਲ ਬਹੁਤ ਹੌਂਸਲਾ ਮਿਲਦਾ ਹੈ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਮੈਂ ਬਹੁਤ ਛੇਤੀ ਭਾਵੁਕ ਹੋ ਜਾਂਦੀ ਹਾਂ ਅਤੇ ਮੈਨੂੰ ਗੁੱਸਾ ਵੀ ਬਹੁਤ ਆਉਂਦਾ ਹੈ ਕਈ ਵਾਰ ਇਹਨਾਂ ਕਮਜ਼ੋਰੀਆਂ ਕਾਰਨ ਮੈਂ ਮੁਸ਼ਕਿਲ ਵਿੱਚ ਵੀ ਪਈ ਹਾਂ